ਬਾਈਕਾਂ ਦੇ ਵਿੱਚ ਪਲੈਟੀਨਾ ਅਤੇ ਸਪਲੈਂਡਰ ਇਹ ਜਿਹੜੀਆਂ ਸਾਡੀਆਂ ਜਿਹੜੀਆਂ ਮਨਪਸੰਦ ਬਾਈਕਾਂ ਨੇ ਅਤੇ ਮੇਰੇ ਕੋਲ ਆਪਣੇ ਕੋਲ ਵੀ ਜਿਹੜੀ ਪਲੈਟੀਨਾ ਬਾਈਕ ਹੈ ਪਲੈਟੀਨਾ ਬਾਈਕ ਜਿਹੜੀ ਆ ਇਹਦੀ ਮਾਈਲੇਜ ਬਹੁਤ ਵਧੀਆ ਤੇਲ ਦਾ ਖਰਚਾ ਕਾਫੀ ਘੱਟ ਆ ਐਵਰੇਜ ਬਹੁਤ ਚੰਗੀ ਆ ਇੱਕ ਇਸ ਦੀ ਇਹ ਰਿਪੇਅਰ ਦਾ ਖਰਚਾ ਬਹੁਤ ਘੱਟ ਆ ਰਿਪੇਅਰ ਬਹੁਤ ਘੱਟ ਪੈਂਦੀ ਹੈ ਇਸ ਦੀ ਰਿਪੇਅਰ ਤਾਂ ਸਮਝ ਲਓ ਹੈ ਹੀ ਨਹੀਂ ਇੰਨੀ ਦੂਸਰੀਆਂ ਬਾਈਕਾਂ ਦੇ ਮੁਕਾਬਲੇ ਇਸ ਦਾ ਖਰਚਾ ਕਾਫੀ ਘੱਟ ਆ ਦੂਸਰੀਆਂ ਬਾਈਕਾਂ ਦੀ ਜਿਹੜੀ ਆ ਰਿਪੇਅਰ ਆ ਰਿਪੇਅਰ ਦਾ ਖਰਚਾ ਜ਼ਿਆਦਾ ਅਤੇ ਬਾਈਕਾਂ ਦੇ ਜੇ ਆਰਾਮਦਾਇਕ ਦੀ ਗੱਲ ਕਰੀਏ ਯਾਤਰਾਵਾਂ ਦੇ ਵਿੱਚ ਆਰਾਮ ਦੀ ਗੱਲ ਕੀਤੀ ਜਾਵੇ ਤਾਂ ਆਰਾਮ ਦੇ ਸਿਲਸਿਲੇ ਦੇ ਵਿੱਚ ਇਹ ਇਹ ਬਾਈਕਾਂ ਦਾ ਇੰਨਾ ਆਰਾਮ ਨਹੀਂ ਹੈਗਾ ਬਾਈਕਾਂ ਦੇ ਮੁਕਾਬਲੇ ਜੇ ਐਕਟਿਵਾ ਜਿਹੜੀ ਆ ਜਾਂ ਹੋਂਡਾ ਅਟਰਨੋ ਹੈਗੀ ਆ ਉਨ ਜਾਰੀ ਜਿਹੜੀ ਹੈਗੀ ਆ ਆਰਾਮਦਾਇਕ ਹੈਗੀ ਆ ਉਸ ਦੇ ਵਿੱਚ ਝਟਕਾ ਘੱਟ ਪੈਂਦਾ ਵਾ ਸੀਟ ਚੌੜੀ ਅਤੇ ਆਰਾਮਦਾਇਕ ਆ ਜਿੱਥੇ ਥਕਾਵਟ ਨਹੀਂ ਹੁੰਦੀ ਛੇਤੀ ਜ਼ਿਆਦਾ ਦੇਰ ਬੰਦਾ ਉੱਤੇ ਸਫ਼ਰ ਕਰ ਸਕਦਾ ਬਾਕੀ ਰੱਖ ਰਖਾਵ ਦੀ ਸਹੂਲਤ ਵੀ ਜਿਆਦੀ ਆ ਰੱਖਣ ਦੇ ਬਾ ਬਾਕਸ ਅਤੇ ਉਸ ਦੇ ਵਿੱਚ ਇੱਕ ਸੈਪਰੇਟ ਜਿਹੜਾ ਬੋਕਸ ਹੈਗਾ ਵਾ ਯਾਨੀ ਕਿ ਡਿੱਗੀ ਹੈਗੀ ਜਿਸ ਦੇ ਵਿੱਚ ਆਪਣਾ ਸਮਾਨ ਰੱਖਿਆ ਜਾ ਸਕਦਾ ਜਿਹੜਾ ਕਿ ਆਮ ਬਾਈਕਾਂ ਦੇ ਵਿੱਚ ਨਹੀਂ ਮਿਲਦਾ ਇਹ ਜਿਹੜੀ ਇੱਕ ਬੜੀ ਵੱਡੀ ਸਹੂਲਤ ਹੈਗੀ ਆ ਅਤੇ ਇਸ ਲਈ ਵੱਖ ਵੈਸੇ ਵੀ ਇਹ ਆਰਾਮਦਾਇਕ ਹੁੰਦੀ ਆ ਛੋਕਰ ਚੰਗੇ ਹੋਣ ਕਾਰਨ